ਮੈਂ ਪਹਿਲੀ ਵਾਰ ਤੈਰਾਕੀ ਦੋ ਹਜ਼ਾਰ ਵੀਹ ਵਿੱਚ ਸਿੱਖੀ ਅਤੇ ਸਾਡੇ ਰੋਪੜ ਸ਼ਹਿਰ ਵਿੱਚ ਨਹਿਰੂ ਸਟੇਡੀਅਮ ਦੇ ਨੇੜੇ ਸਵੀਮਿੰਗ ਪੂਲ ਬਣਿਆ ਹੋਇਆ ਹੈ ਜਿੱਥੇ ਕਿ ਬੱਚਿਆਂ ਨੂੰ ਤੈਰਾਕੀ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਸਦੇ ਸ਼ੁਰੂਆਤੀ ਸਟ੍ਰੋਕ ਹਨ ਫਰੀਸਟਾਈਲ ਬਟਰਫਲਾਈ ਬ੍ਰੈਸਟ ਸਕੂ ਸਟ੍ਰੋਕ ਬੈਕਸਟ੍ਰੋਕ ਬਟਰਫਲਾਈ ਵਿੱਚ ਬਾਹਾਂ ਨੂੰ ਫੈਲਾ ਕੇ ਤੈਰਾਕੀ ਸਿਖਾਉਂਦੇ ਹਨ ਅਤੇ ਬੈਕਸਟ੍ਰੋਕ ਵਿੱਚ ਬੈਕ ਪਿੱਛੇ ਨੂੰ ਪਿੱਛੇ ਨੂੰ ਜਾ ਕੇ ਤੈਰਾਕੀ ਸਿਖਾਉਂਦ ਸਿਖਾਈ ਜਾਂਦੀ ਹੈ ਮੈਨੂੰ ਪਾਣੀ ਤੋਂ ਪਹਿਲਾਂ ਪਹਿਲਾਂ ਬਹੁਤ ਡਰ ਲੱਗਦਾ ਸੀ ਕਿਉਂਕਿ ਮੈਂ ਪਾਣੀ ਵਿੱਚ ਘੱਟ ਹੀ ਜਾਂਦੀ ਸੀ ਪਰ ਹੁਣ ਹੌਲੀ ਹੌਲੀ ਮੈਨੂੰ ਪਾਣੀ ਤੋਂ ਡਰ ਨਹੀਂ ਲੱਗਦਾ ਇਸ ਇਸ ਕਰਕੇ ਮੈਨੂੰ ਹੁਣ ਤੈਰਾਕੀ ਵਧੀਆ ਤਰੀਕੇ ਦੇ ਨਾਲ ਆਈ ਹੈ ਅਤੇ ਸਾਨੂੰ ਤੈਰਾਕੀ ਸਾਡੀ ਮੈਡਮ ਸੰਗੀਤਾ ਸੰਗੀਤਾ ਮੈਡਮ ਨੇ ਸਾਨੂੰ ਬਹੁਤ ਅੱਛੀ ਤਰ੍ਹਾਂ ਸਿਖਲਾਈ ਦਿੱਤੀ ਹੈ